ਹਾਂ ਮੈਂ ਸ਼ੁਰੂਆਤੀ ਸਮੇਂ ਦੇ ਵਿੱਚ ਯੋਗਾ ਦੀ ਕਲਾਸ ਲਗਾਈ ਸੀ ਮੇਰਾ ਕਲਾਸ ਦੇ ਵਿੱਚ ਯੋਗਾ ਯੋਗਾ ਦਾ ਤਜਰਬਾ ਵਧੀਆ ਸੀ ਸਾਡੇ ਗੁਰੂ ਜੀ ਸਾਡੇ ਸਾਹਮਣੇ ਬੈਠ ਕੇ ਯੋਗਾ ਕਰਦੇ ਸੀ ਅਤੇ ਸਾਨੂੰ ਸ ਸ਼ੁਰੂ ਤੋਂ ਸਿਖਲਾਈ ਦਿੱਤੀ ਜਾਂਦੀ ਸੀ ਅਤੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਨੇ ਦੱਸੇ ਗਏ ਸਟੈਪਸ ਕਰਦੇ ਸੀ ਕਲਾ ਕਲਾਸ ਦੇ ਨਾਲੋਂ ਘਰ ਵਿੱਚ ਅਭਿਆਸ ਕਰਨ ਦਾ ਇਹ ਵੱਖਰਾ ਫਾਇਦਾ ਹੁੰਦਾ ਹੈ ਕਿ ਕਲਾਸ ਦੇ ਵਿੱਚ ਅਸੀਂ ਸਾਰਿਆਂ ਦੇ ਨੂੰ ਦੇਖ ਕੇ ਚੱਲਣ ਲੱਗਦਾ ਹੈ ਬਲਕਿ ਅ ਜੇਕਰ ਅਸੀਂ ਘਰ ਇਕੱਲੇ ਕਰ ਰਹੇ ਹੋਵਾਂਗੇ ਤਾਂ ਸ਼ਾਂਤ ਜਗ੍ਹਾ ਹੁੰਦੀ ਹੈ ਅਤੇ ਸਾਨੂੰ ਸਾਡਾ ਮਨ ਭਟਕਣਾ ਜਾਂ ਸਾਨੂੰ ਤੰਗ ਕਰਨ ਵਾਲਾ ਜਿਸ ਨਾਲ ਸਾਡਾ ਕਿ ਸ਼ਾਂਤੀ ਭੰਗ ਹੋਵੇ ਅਤੇ ਸਾਡਾ ਧਿਆਨ ਭਟਕੇ ਇਵੇਂ ਦੇ ਹਾਲਾਤ ਬਹੁਤ ਘੱਟ ਹੁੰਦੇ ਹਨ